ਮੇਰੇ ਮਨਪਸੰਦੀ ਮੱਛੀ ਜਿਵੇਂ ਕੀ ਸ਼ੈੱਡ ਮੱਛੀ ਹੋ ਗਈ ਰੈੱਡ ਸਨੈਪਰ ਮੱਛੀ ਹੋ ਗਈ ਇਹ ਕਾਫੀ ਜ਼ਿਆਦਾ ਮੈਨੂੰ ਸਵਾਦ ਲੱਗਦੀ ਹੈ ਇਹਦੇ ਵਿੱਚ ਕਾਫ਼ੀ ਜ਼ਿਆਦਾ ਤੱਤ ਹੁੰਦੇ ਨੇ ਪ੍ਰੋਟੀਨ ਵਗੈਰਾ ਅਤੇ ਹੋਰ ਕਾਫੀ ਜ਼ਿਆਦਾ ਖਾਣ 'ਚ ਵੀ ਬਹੁਤ ਸਵਾਦ ਹੁੰਦੀ ਹੈ ਜਿੱਦਾਂ ਕਿ ਲੋਕਾਂ ਨੂੰ ਲੋਕਾਂ ਨੂੰ ਪਸੰਦ ਤੋਰ 'ਤੇ ਮੱਛੀ ਹੈਗੀ ਹੈ ਪੋਲਟ ਮੱਛੀ ਹੋ ਗਈ ਫੁੰਗਸ ਮੱਛੀ ਹੋ ਗਈ ਕਾਰਪ ਮੱਛੀ ਹੋ ਗਈ ਹਰ ਇੱਕ ਨੂੰ ਲਾਏ ਅਲੱਗ ਅਲੱਗ ਤਰ੍ਹਾਂ ਦਾ ਸਵਾਦ ਆ ਹਰ ਇੱਕ ਨੂੰ ਜਿੱਦਾਂ ਦੀ ਵੀ ਖਾਣ ਨੂੰ ਵਧੀਆ ਲਗਦੀ ਆ ਮੱਛੀ ਓਦਾਂ ਦੇ ਤੋਰ 'ਤੇ ਮੱਛੀ ਖਾਂਦਾ ਹੈ